ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਭਜੋਤ ਕੌਰ ਹੈ ਅਤੇ ਮੈਨੇ ਤੁਹਾਡੇ ਸ਼ੋਪਸ ਗੋਪਾਲ ਸਵੀਟਸ ਤੋਂ ਆਪਣਾ ਔਡਰ ਕੀਤਾ ਸੀ ਜਿਸ ਵਿੱਚ ਕੇਕ ਰਸ ਮਲਾਈ ਅਤੇ ਗੁਲਾਬ ਜਾਮਣ ਸੀ ਜੋ ਕਿ ਮੈਨੇ ਦਸ ਮਿੰਟ ਪਹਿਲਾਂ ਕੀਤਾ ਸੀ ਔਡਰ ਅਤੇ ਮੈਨੂੰ ਕਿਸੇ ਕੰਮ ਕਰਕੇ ਅਚਾਨਕ ਹੀ ਕੋਲੇਜ ਜਾਣਾ ਪੈ ਗਿਆ ਅਤੇ ਮੈਂ ਤੁਹਾਡਾ ਔਡਰ ਨਹੀਂ ਰਿਸੀਵ ਕਰ ਸਕਦੀ ਅਤੇ ਮੈਨੂੰ ਇਹ ਔਡਰ ਕੈਂਸਲ ਕਰਨਾ ਪਵੇਗਾ ਤਾਂ ਕਿਰਪਾ ਕਰਕੇ ਮੈਨੂੰ ਮੇਰੇ ਪੈਸੇ ਜੋ ਕਿ ਮੈਨੇ ਪਹਿਲਾਂ ਹੀ ਔਡਰ ਦੇ ਪੇਮੈਂਟ ਤੁਹਾਨੂੰ ਕਰ ਦਿੱਤੇ ਸੀ ਉਹ ਮੈਨੂੰ ਮੇਰੇ ਗੂਗਲ ਪੇਅ ਦੇ ਨੰਬਰ 'ਤੇ ਰਿਫੰਡ ਕਰ ਦਿੱਤੇ ਜਾਣ ਅਤੇ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ ਤੁਸੀਂ ਮੇਰੇ ਪੈਸੇ ਮੈਨੂੰ ਜਲਦੀ ਤੋ ਜਲਦੀ ਰਿਫੰਡ ਕਰ ਦੇਵੋਂਗੇ ਮੈਂ ਹੋਰ ਚੀਜ਼ਾਂ ਵੀ ਤੁਹਾਡੇ ਤੋਂ ਹੀ ਮੰਗਾਉਂਦੀ ਰਹਿੰਦੀ ਹਾਂ ਅਤੇ ਮੈਂ ਅੱਗੇ ਵੀ ਤੁਹਾਡੇ ਤੋਂ ਹੀ ਆਪਣੇ ਔਡਰ ਕਰਦੀ ਰਹਾਂਗੀ ਧੰਨਵਾਦ